ਹਾਂਜੀ ਮੈਂ ਵੀ ਪੀ ਟੀ ਊਸ਼ਾ ਦਾ ਨਾਮ ਸੁਣਿਆ ਹੈ ਉਹਨਾਂ ਬਾਰੇ ਇਹ ਸੁਣਿਆ ਹੈ ਕਿ ਉਹ ਬਹੁਤ ਵਧੀਆ ਦੌੜਨ ਵਾਲੀ ਵੁਮੈਨ ਸੀ ਜਿਹਨੇ ਕਿ ਦੌੜ ਕੇ ਐਥਲੀਟਸ 'ਚ ਬੜੇ ਮੈਡਲ ਹਾਸਿਲ ਕੀਤੇ ਬੜਾ ਦੇਸ਼ ਦਾ ਨਾਮ ਰੌਸ਼ਨ ਕੀਤਾ ਕਿਉਂਕਿ ਦੇਖੋ ਜਿਸ ਦੇਸ਼ ਦੇ ਵਿੱਚ ਸਿਰਫ ਸਪੋਰਟਸ ਜਿਹੜੀਆਂ ਨੇ ਉਹਨਾਂ ਨੂੰ ਮੁੰਡਿਆਂ ਨਾਲ ਜੋੜਿਆ ਜਾਂਦਾ ਕੁਝ ਸਮੇਂ ਪਹਿਲਾਂ ਤਾਂ ਇਹ ਸੀਗਾ ਕਿ ਜਿਹੜੀਆਂ ਖੇਡਾਂ ਨੇ ਉਹ ਇਕੱਲੇ ਮੁੰਡਿਆਂ ਲਈ ਹੈ ਲੇਕਿਨ ਅੱਜ ਦੇ ਯੁੱਗ ਦੇ ਵਿੱਚ ਪੀ ਟੀ ਊਸ਼ਾ ਵਰਗੀਆਂ ਔਰਤਾਂ ਨੇ ਆ ਕੇ ਔਰਤਾਂ ਦਾ ਵੀ ਕਹਿ ਲਓ ਕਿ ਵਿਸ਼ਵ ਦੇ ਵਿੱਚ ਨਾਮ ਕੀਤਾ ਹੈ ਨਹੀਂ ਤਾਂ ਔਰਤਾਂ ਨੂੰ ਕੇਵਲ ਘਰ 'ਚ ਰੋਟੀ ਪਾਣੀ ਬਣਾਉਣ ਲਈ ਓ ਹੀ ਸਮਝਿਆ ਜਾਂਦਾ ਸੀ ਲੇਕਿਨ ਪੀ ਟੀ ਊਸ਼ਾ ਨੇ ਤਾਂ ਔਰਤਾਂ ਦਾ ਸਿਰ ਕਹਿ ਲਓ ਕਿ ਉੱਚਾ ਕਰ ਦਿੱਤਾ ਮੈਂ ਤਾਂ ਦੇਖੋ ਇਹ ਹੀ ਸਿੱਖਣਾ ਚਾਹਾਂਗੀ ਇਹੋ ਜਿਹੀ ਔਰਤ ਕੋਲੋਂ ਕਿ ਕਿਸ ਤਰ੍ਹਾਂ ਉਹਨੇ ਸਮਾਜ ਵਿੱਚੋਂ ਨਿਕਲ ਕੇ ਇੱਕ ਐਸੇ ਮੁਕਾਮ ਦੇ ਵਿੱਚ ਪਹੁੰਚੀ ਅਤੇ ਸਭ ਤੋਂ ਵੱਡੀ ਗੱਲ ਜਿਸ ਤਰ੍ਹਾਂ ਮੈਂ ਵੀ ਇੱਕ ਵਰਕਿੰਗ ਹਾਂ ਸਾਡੇ ਲਈ ਕਿੰਨਾ ਮੁਸ਼ਕਿਲ ਹੈਗਾ ਹੈ ਕਿ ਮੈਨੇਜ ਕਰਨਾ ਘਰ ਵੀ ਆਪਣਾ ਦਫ਼ਤਰ ਵੀ ਆਪਣਾ ਪਰਿਵਾਰ ਵੀ ਹਰ ਚੀਜ਼ ਨੂੰ ਮੈਨੇਜ ਕਰਨਾ ਅਤੇ ਉਹ ਇੱਕ ਸਪੋਰਟਸ ਨਾਲ ਜੁੜ ਕੇ ਕਿ ਜਿੱਥੇ ਕੋਈ ਕਹਿ ਲਓ ਕਿ ਕੰਮ ਦੀ ਕੋਈ ਲਿਮਟ ਹੀ ਨਹੀਂ ਹੈਗੀ ਉਹਨਾਂ ਨੇ ਕਿਸ ਤਰ੍ਹਾਂ ਮੈਨੇਜ ਕੀਤਾ ਹੋਵੇਗਾ